ਸਾਡੇ ਇੱਥੇ ਵੈਸੇ ਤਾਂ ਬਹੁਤ ਹੀ ਮੈਂ ਬਹੁਤ ਜਗ੍ਹਾ ਘੁੰਮਿਆਂ ਪਰ ਲਾਸਟ ਮਨ ਲਾਸਟ ਮਹੀਨੇ ਮੈਂ ਆਪਣੇ ਦੋਸਤਾਂ ਨਾਲ ਨੈਣਾ ਦੇਵੀ ਗਿਆ ਘੁੰਮਣ ਗਿਆ ਸੀਗਾ ਅਤੇ ਉਹ ਤੁਹਾਡੇ ਨਾਲ ਮੈਂ ਆਪਣੀ ਯਾਤਰਾ ਸਾਂਝੀ ਕਰਨ ਲੱਗਿਆਂ ਜਦੋਂ ਆਪਾਂ ਆਪਣੇ ਘਰ ਤੋਂ ਮੈਂ ਦੋਸਤਾਂ ਨਾਲ ਉੱਥੇ ਨੈਣਾ ਦੇਵੀ ਗਿਆ ਤਾਂ ਉੱਥੇ ਦਾ ਮੇਰਾ ਉੱਥੇ ਦਾ ਐਕਸਪੀਰੀਐਂਸ ਅਨੁਭਵ ਉੱਥੇ ਬਹੁਤ ਵਧੀਆ ਰਿਹਾ ਜਦੋਂ ਮੈਂ ਉੱਥੇ ਗਿਆ ਤਾਂ ਉੱਥੋਂ ਮੈਂ ਉੱਪਰ ਤੱਕ ਮੰਦਰ ਤੱਕ ਪੌੜੀਆਂ ਰਾਹੀਂ ਚੜ੍ਹਿਆ ਜਦੋਂ ਉੱਪਰ ਚੜ੍ਹਦੇ ਚੜ੍ਹਦੇ ਮੈਂ ਕਾਫੀ ਬਾਂਦਰ ਵੀ ਦੇਖੇ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਵੀ ਵੇਖੀਆਂ ਖਾਣ ਪੀਣ ਦਾ ਵਧੀਆ ਸਮਾਨ ਵੀ ਦੇਖਿਆ ਵਧੀਆ ਵਧੀਆ ਮੈਨੂੰ ਦ੍ਰਿਸ਼ ਵੀ ਦਿਖਦੇ ਰਹੇ ਅਤੇ ਅੱਗੇ ਜਾ ਕੇ ਮੈਨੂੰ ਇੱਦਾਂ ਲੱਗਿਆ ਜਿਵੇਂ ਮੈਂ ਬੱਦਲਾਂ ਤੋਂ ਵੀ ਉੱਚੀ ਆ ਗਿਆ ਬੱਦਲਾਂ ਤੋਂ ਉੱਪਰ ਉੱਡਦਾ ਹੋਵੇ ਤਦੋਂ ਜਦੋਂ ਮੈਂ ਪਹਿਲਾਂ ਮੈਨੂੰ ਪਹਾੜੀਆਂ ਤੋਂ ਕਾਫੀ ਡਰ ਲੱਗਦਾ ਸੀਗਾ ਅਤੇ ਹੁਣ ਹੁਣ ਮੈਂ ਜਦੋਂ ਪਹਾੜੀਆਂ ਤੋਂ ਜਦੋਂ ਉੱਪਰ ਜਾ ਕੇ ਦੇਖਿਆ ਤਾਂ ਮੇਰਾ ਡਰ ਸਾਰਾ ਚੱਕ ਹੋ ਗਿਆ ਅਤੇ ਮੈਨੂੰ ਹੁਣ ਪਹਾੜੀਆਂ ਤੋਂ ਕੋਈ ਵੀ ਡਰ ਨਹੀਂ ਲੱਗਦਾ ਹੈਗਾ